ਘਰ ਵਿੱਚ ਚਾਹ ਕੋਫੀ ਦੁੱਧ ਲੱਸੀ ਹੋਰ ਕਈ ਤਰ੍ਹਾਂ ਦੇ ਸ਼ਰਬਤ ਗਰਮੀਆਂ 'ਚ ਪੀਣ ਵਾਲੇ ਸਕੈਚ ਵਗੈਰਾ ਜਾਂ ਫਿਰ ਕੋਈ ਜਲਜੀਰਾ ਟਾਈਪ ਘਰ ਮਸਾਲਾ ਤਿਆਰ ਕਰਕੇ ਇਹ ਜਿਹੜੀਆਂ ਸਾਰੀਆਂ ਪੀਣ ਵਾਲੀਆਂ ਚੀਜ਼ਾਂ ਏ ਇਹ ਜਿਹੜੀਆਂ ਬਣਾਈਆਂ ਜਾਂਦੀਆ ਏ